ਮੈਂ ਆਪਣੀ ਆਰਮੀ ਦੀ ਡਿਊਟੀ ਦੇ ਦੌਰਾਨ ਸ੍ਰੀਨਗਰ ਤੋਂ ਸੱਠ ਕਿਲੋਮੀਟਰ ਦੂਰ ਸੋਨਾਮਾਰ ਰੋਡ ਤੋਂ ਅਮਰਨਾਥ ਯਾਤਰਾ ਜਿੱਥੇ ਸਾਰੇ ਸ਼ਰਧਾਲੂ ਮੱਥਾ ਟੇਕਣ ਜਾਂਦੇ ਹਨ ਉੱਥੇ ਗਿਆ ਸੀ ਅਤੇ ਬਹੁਤ ਬਹੁਤ ਵਧੀਆ ਜਗ੍ਹਾ ਹੈ ਅਤੇ ਉੱਥੇ ਧਾਰਮਿਕ ਅਸਥਾਨ ਵੀ ਬਹੁਤ ਵਧੀਆ ਹੈ ਲੋਕ ਸਾਲ ਵਿੱਚ ਇੱਕ ਵਾਰ ਜ਼ਰੂਰ ਜਾਂਦੇ ਹਨ ਅਤੇ ਮੈਂ ਤਾਂ ਘੱਟੋ ਘੱਟ ਦੋ ਤਿੰਨ ਵਾਰ ਗਿਆ ਹਾਂ ਉੱਥੇ ਉੱਥੋਂ ਦੀਆਂ ਪਹਾੜੀਆਂ ਅਤੇ ਉੱਥੋਂ ਦੇ ਪੇੜ ਜਿਹੜਾ ਉੱਥੋਂ ਦਾ ਵਾਤਾਵਰਨ ਜਿੱਥੇ ਬਰਫਬਾਰੀ ਹੁੰਦੀ ਹੈ ਉੱਥੋਂ ਦੇ ਉੱਥੇ ਜਿੱਦਾਂ ਕਿ ਡਰਾਈ ਫਰੂਟ ਜਿਵੇਂ ਕਿ ਅਖਰੋਟ ਬਦਾਮ ਇਹ ਵੀ ਬਹੁਤ ਹੁੰਦੇ ਹਨ ਅਤੇ ਬਾਕੀ ਜਿਹੜੀ ਗੁਫਾ ਵਿੱਚ ਬਰਫ ਦਾ ਅਮਰਨਾਥ ਦੀ ਯਾਤਰਾ ਦਾ ਬਰਫ ਦਾ ਸ਼ਿਵਲਿੰਗ ਬਣਦਾ ਹੈ ਉਹ ਬਹੁਤ ਦੇਖਣ ਯੋਗ ਹੁੰਦਾ ਹੈ ਅਤੇ ਲੋਕ ਉਸ ਹੀ ਨੂੰ ਉਹਦੇ ਦਰਸ਼ਨ ਕਰਨ ਵਾਸਤੇ ਉੱਥੇ ਜਾਂਦੇ ਹਨ ਇਹ ਬਹੁਤ ਖੁਸ਼ੀ ਨਾਲ਼ ਅਤੇ ਮਨ ਦੀ ਸ਼ਰਧਾ ਨਾਲ ਮੱਥਾ ਟੇਕ ਕੇ ਉੱਥੋਂ ਆਉਂਦੇ ਹਨ ਇਸ ਤੋਂ ਇਲਾਵਾ ਉਸ ਤੋਂ ਉੱਧਰ ਸ਼੍ਰੀਨਗਰ ਵਿੱਚ ਹੋਰ ਵੀ ਘੁੰਮਣ ਦੀ ਬਹੁਤ ਜਗ੍ਹਾ ਹੈ ਲੇਕਿਨ ਮੇਨ ਲੋਕ ਮੱਥਾ ਟੇਕ ਕੇ ਆਪਣਾ ਵਾਪਸ ਘੁੰਮ ਫਿਰ ਕੇ ਸਾਰੇ ਵਾਪਸ ਘਰ ਆਉਂਦੇ ਹਨ